ਜੇਕਰ ਤੁਸੀਂ ਗਾਇਕ ਜਾਂ ਸੰਗੀਤਕਾਰ ਦੀ ਗੱਲ ਕਰ ਰਹੇ ਹੋ ਤਾਂ ਬਹੁਤੇ ਕਲਾਕਾਰ ਆਪਣੇ ਬਚਪਨ ਵਿੱਚ ਹੀ ਸੰਗੀਤ ਪ੍ਰਤੀ ਰੁਚੀ ਮਹਿਸੂਸ ਕਰਦੇ ਹਨ ਕਈ ਲੋਕ ਆਪਣੇ ਪਰਿਵਾਰ ਗੁਰੂ ਜਾਂ ਆਸ ਪਾਸ ਦੇ ਮਾਹੌਲ ਕਰਕੇ ਪ੍ਰੇਰਿਤ ਹੁੰਦੇ ਹਨ ਮੈਨੂੰ ਪਹਿਲੀ ਵਾਰ ਗਾਉਣ ਵਿੱਚ ਰੁਚੀ ਤਦ ਆਈ ਜਦੋਂ ਕਿ ਮੈਂ ਆਪਣੇ ਪਿਤਾ ਸ਼੍ਰੀ ਤੋਂ ਇਹ ਗਾਇਕ ਦੀ ਅਨੁਭਵਤਾ ਲਿੱਤੀ ਮੈਂ ਅਸਲ ਵਿੱਚ ਮੇਰੇ ਪਿਤਾ ਜੀ ਖੁਦ ਇੱਕ ਪਾਠੀ ਹਨ ਅਤੇ ਉਹ ਖੁਦ ਗੁਰਦੁਆਰੇ ਵਿੱਚ ਪ ਕੀਰਤਨ ਕਰਦੇ ਹਨ ਅਤੇ ਛੋਟੇ ਹੁੰਦੇ ਤੋਂ ਹੀ ਘਰ ਦਾ ਮਾਹੌਲ ਇਸ ਤਰੀਕੇ ਦਾ ਸੀ ਕਿ ਜਿਸ ਵਿੱਚ ਮੈਨੂੰ ਗਾਉਣ ਦੀ ਰੁਚੀ ਬਹੁਤ ਜ਼ਿਆਦਾ ਆਈ ਮੈਂ ਅਸਲ ਵਿੱਚ ਚਾਰ ਸਾਲ ਦੀ ਉਮਰ ਤੋਂ ਗਾਇਕੀ ਦੇ ਵਿੱਚ ਹਾਂ ਆਪਣੇ ਪਰਿਵਾਰ ਕਰਕੇ ਮੈਨੂੰ ਗਾਇਕੀ ਵਿੱਚ ਬਹੁਤ ਜ਼ਿਆਦਾ ਪ੍ਰਤਿਭਾ ਖੋਜੀ ਮੈਂ ਆਪਣੀ ਅਤੇ ਇਸ ਕਰਕੇ ਹੀ ਬਹੁਤ ਸਾਰੀ ਮੇਰੀ ਖੁਦ ਦੀ ਮਦਦ ਵੀ ਹੋਈ ਅਤੇ ਮੇਰੇ ਪਿਤਾ ਸ਼੍ਰੀ ਨੇ ਬਹੁਤ ਜ਼ਿਆਦਾ ਇਸ ਵਿੱਚ ਮਦਦ ਕੀਤੀ ਮੇਰੇ ਦਾਦੂ ਵੀ ਇਸ ਇਸ ਹੀ ਕੈਟਾਗਰੀ ਦੇ ਵਿੱਚ ਸੀ ਅਤੇ ਆਪਣੇ ਘਰ ਦਾ ਮਾਹੌਲ ਦੇਖ ਚਾਲ ਕਰਕੇ ਮੈਨੂੰ ਗਾਉਣ ਵਿੱਚ ਬਹੁਤ ਜ਼ਿਆਦਾ ਰੁਚੀ ਪਈ ਹੁਣ ਮੈਂ ਵੀ ਗੁਰਦੁਆਰੇ ਵਿੱਚ ਕੀਰਤਨ ਕਰਕੇ ਆਪਣੇ ਘਰ ਦੀ ਮਦਦ ਕਰਤੀ ਹਾਂ ਅਤੇ ਇਸ ਤਰੀਕੇ ਨਾਲ ਮੈਨੂੰ ਗਾਉਣ ਵਿੱਚ ਬਹੁਤ ਜ਼ਿਆਦਾ ਰੁਚੀ ਪਈ ਜਿਸ ਕਰਕੇ ਮੇਰੇ ਘਰ ਦੇ ਵੀ ਮੈਨੂੰ ਬਹੁਤ ਖੁਸ਼ ਖੁਸ਼ਕਿਸਮਤ ਸਮਝਦੇ ਹਨ